ਹੈਲੋ

ਹੈਲੋ ਹਾਂ ਬੇਟਾ ਤੁਸੀਂ ਸਕੂਲ ਬਹੁਤ ਘੱਟ ਆਏ ਹੋ ਕੀ ਗੱਲ ਹੈ ਕੀ ਪ੍ਰੋਬਲਮ ਹੈ ਹਾਂਜੀ ਉਹ ਮੈਂ ਕਾਫੀ ਦਿਨਾਂ ਤੋਂ ਵੇਖਦਾ ਤੁਹਾਡੀ ਹਾਜ਼ਰੀ ਬਹੁਤ ਘੱਟ ਹੈ ਰਜਿਸਟਰ 'ਤੇ ਅੱਛਾ ਜ਼ਿਆਦਾ ਸ਼ਰਾਰਤਾਂ ਵੱਲ ਧਿਆਨ ਰੱਖਦੇ ਜਾਦੇ ਤੁਸੀਂ ਅੱਛਾ ਅੱਛਾ ਅਤੇ ਕੀ ਹੁਣ ਠੀਕ ਹੈ ਬੁਖਾਰ ਅੱਛਾ ਹੁਣ ਛੁੱਟੀਆਂ ਤਾਂ ਨਹੀਂ ਕਰੋਗੇ ਅੱਛਾ ਜੋ ਤਰੀਕ 'ਚ ਅੱਜ ਕੱਲ੍ਹ ਹਾਜ਼ਰੀ ਬਹੁਤ ਇਸ ਲਈ ਮੈਂ ਤੁਹਾਨੂੰ ਬੁਲਾਇਆ ਆਪਣੇ ਔਫਿਸ ਵਿੱਚ ਹਾਂਜੀ ਚਲੋ ਠੀਕ ਹੈ ਬੇਟਾ ਅਤੇ ਪਰ ਅਗਾਂਹ ਤੋਂ ਕੋਈ ਤੁਹਾਡੀ ਸ਼ਿਕਾਇਤ ਨਹੀਂ ਆਉਗੀ ਪੜ੍ਹਾਈ ਵਿੱਚ ਕਿੱਦਾਂ ਚਲੋ ਠੀਕ ਆ ਹੁਣ ਤਾਂ ਕੋਈ ਉਹ ਕੰਪਲੇਂਟ ਨਹੀਂ ਆਉਗੀ ਆਪਣੀ ਘਰ ਵਿੱਚ ਬਾਕੀ ਸਭ ਠੀਰ ਠਾਕ ਹੈ ਮੈਨੂੰ ਤਾਂ ਵੇਖਣ ਨੂੰ ਤਾਂ ਤੂੰ ਬੜੀ ਸ਼ਰਾਰਤੀ ਜਿਹਾ ਲੱਗਦਾ

ਜ਼ਿਆਦਾ ਜ਼ਿਆਦਾ ਘਰਦਿਆਂ ਦਾ ਲਾਡਲਾ ਜ਼ਿਆਦਾ ਵਾ ਹੈ ਨਹੀਂ ਅੱਛਾ ਹੁਣ ਕੋਈ ਕੰਪਲੇਂਟ ਨਹੀਂ ਆਉਗੀ ਹੁਣ ਪੇਪਰਾਂ ਦੀ ਤਿਆਰੀ ਆ ਜਾਂ ਨਹੀਂ ਤਿਆਰੀ ਅੱਛਾ ਜੀ ਅੱਛਾ ਜੀ ਚਲੋ ਠੀਕ ਹੈ ਬੇਟਾ ਹੈ ਕੋਈ ਇਹੋ ਜਿਹੀ ਸ਼ਿਕਾਇਤ ਨਹੀਂ ਆਉਣੀ ਚਾਹੀਦੀ ਹੈ ਜੇ ਹੁਣ ਆਈ ਤਾਂ ਮੈਂ ਤੁਹਾਡੀ ਮੈਡਮ ਨੂੰ ਪੁੱਛ ਲੈਣਾ ਜੋ ਚਲੋ ਠੀਕ ਹੈ ਹੈ ਚਲੋ ਠੀਕ ਹੈ